ਹਾਂਜੀ ਸੱਸ਼ੀਕਾਲ ਜੀ ਮੇਰਾ ਨਾਮ ਰਜਨੀ ਹੈ ਤੇ ਮੈਂ ਗੁਰਦਾਸਪੁਰ ਤੋਂ ਬੋਲਦੀ ਗਈ ਆ ਸ਼ੰਕਰ ਨਗਰ ਮਹੱਲੇ ਤੋਂ ਸਾਡੇ ਮਤਲਬ ਮੁਹੱਲੇ ਚ ਸਭ ਤੋਂ ਵੱਡੀ ਸਮੱਸਿਆ ਹੈ ਕਿ ਸਾਡੇ ਖੇਤਰ ਵਿੱਚ ਕੀ ਹੈਗਾ ਕਿ ਪਾਣੀ ਮਤਲਬ ਜਿਹੜਾ ਬਹੁਤ ਗੰਦਾ ਆ ਰਿਹਾ ਤੇ ਉਹਦੀ ਕਰਕੇ ਕੀ ਹੁੰਦਾ ਲੋਕਾਂ ਨੂੰ ਬੜੀ ਸਾਰੀ ਸਮੱਸਿਆ ਦਾ ਸਮਾਧਾਨ ਕਰਨਾ ਪੈਂਦਾ ਤੇ ਮਤਲਬ ਜਿਹੜਾ ਪਾਣੀ ਜਿਹੜਾ ਹੈਗਾ ਸਵੇਰੇ ਇਨਾ ਗੰਦਾ ਆਉਂਦਾ ਕਿ ਮਤਲਬ ਇਹਦੇ ਨਾਲ ਸਾਨੂੰ ਕੰਮ ਕੰਮ ਕਰਨਾ ਵੀ ਨੀ ਚੰਗਾ ਲੱਗਦਾ ਕਿਉਂਕਿ ਇਹਦੇ ਚ ਪਾਣੀ ਚ ਬਹੁਤ ਸਾਰੀਆਂ ਮਤਲਬ ਸਮੈਲ ਆਉਂਦੀ ਹੈ ਬਹੁਤ ਸਾਰਾ ਗੰਦਗੀ ਆਉਂਦੀ ਆ ਤੇ ਜਿਸ ਕਰਕੇ ਲੋਕਾਂ ਨੂੰ ਬੜੀ ਮਤਲਬ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਤੇ ਅਸੀਂ ਵਾਟਰ ਸਪਲਾਈ ਵਿੱਚ ਵੀ ਕਈ ਵਾਰੀ ਉਹਨਾਂ ਨੂੰ ਮਤਲਬ ਸ਼ਿਕਾਇਤ ਕੀਤੀ ਹੈਗੀ ਐ ਕੀ ਸਾਡਾ ਜਿਹੜਾ ਪਾਣੀ ਆ ਬਹੁਤ ਗੰਦਾ ਆ ਰਿਹਾ ਤੇ ਉਹਨਾਂ ਨੇ ਮਤਲਬ ਕਈ ਵਾਰੀ ਉਹ ਚੈਕਿੰਗ ਵੀ ਕਰਕੇ ਗਏ ਹਨ ਤੇ ਅਸੀਂ ਤੁਹਾਡੇ ਮਤਲਬ ਬਹੁਤ